ਖੇਡਾਂ ਦਾ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਇਸ ਲਈ ਵਧੀਆ ਕੋਚ ਵਧੀਆ ਟ੍ਰੇਨਰ ਦਾ ਹੋਣਾ ਜ਼ਰੂਰੀ ਹੈ ਵਧੀਆ ਕੋਚ ਅਤੇ ਟ੍ਰੇਨਰ ਹੀ ਖਿਡਾਰੀਆਂ ਦੀ ਛੁਪੀ ਹੋਈ ਲਿਆਕਤ ਨੂੰ ਨਿਖਾਰ ਕੇ ਸਾਹਮਣੇ ਲਿਆ ਸਕਦਾ ਹੈ ਚੰਗਾ ਕੋਚ ਅਤੇ ਟ੍ਰੇਨਰ ਹੀ ਖਿਡਾਰੀਆਂ ਨੂੰ ਵਧੀਆ ਤਰੀਕੇ ਨਾਲ ਜਾਣਨਾ ਤਾਂ ਜੋ ਵਿਹਾਰ ਵਿੱਚ ਬਦਲਾਅ ਨੂੰ ਨੋਟਿਸ ਕਰਨਾ ਆਸਾਨ ਹੋਵੇ ਟ੍ਰੇਨਰ ਟ੍ਰੇਨਿੰਗ ਦੇਣ ਲਈ ਸੁਰੱਖਿਆ ਅਤੇ ਸਿਹਤਮੰਦ ਵਾਤਾਵਰਣ ਦਿੱਤਾ ਜਾਵੇ ਸਮੇਂ ਸਮੇਂ 'ਤੇ ਟ੍ਰੇਨਿੰਗ ਕੈਂਪ ਲਗਾਏ ਜਾਣ ਦਾ ਪ੍ਰਬੰਧ ਹੋਵੇ ਮੌਜੂਦਾ ਸਰਕਾਰ ਹੀ ਚੰਗੇ ਖਿਡਾਰੀ ਪੈਦਾ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ ਜਿਵੇਂ ਸਰਕਾਰ ਵੱਲੋਂ ਹਰ ਵਰਗ ਦੇ ਖਿਡਾਰੀਆਂ ਲਈ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਅਤੇ ਖੇਡ ਅਤੇ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਕੀਤੀ ਖੇਡਾਂ ਨੂੰ ਉਤਸ਼ਾਹਿਤ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੋਚ ਅਤੇ ਟ੍ਰੇਨਰ ਇੱਕ ਪ੍ਰੇਰਕ ਦੀ ਭੂਮਿਕਾ ਵਜੋਂ ਕੰਮ ਕਰ ਸਕਦਾ ਹੈ